ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਸ਼ਿਵਾ ਸਵੀਟ ਸ਼ੋਪ ਤੋਂ ਬੋਲ ਰਹੇ ਹੋ ਸਰ ਮੈਨੂੰ ਨਾ ਮੈਂ ਤੁਹਾਨੂੰ ਆਰਡਰ ਦੇਣਾ ਸੀਗਾ ਆਪਣੇ ਕੋਲ ਭੁੱਗਾ ਅਤੇ ਖਜੂਰ ਹੋਣਗੇ ਨਾ ਫਰੈਸ਼ ਮੈਨੂੰ ਪੰਦਰ੍ਹਾਂ ਕਿਲੋ ਖਜੂਰ ਅਤੇ ਪੰਦਰ੍ਹਾਂ ਕਿਲੋ ਭੁੱਗਾ ਚਾਹੀਦਾ ਹੈ ਬਾਕੀ ਤਾਂ ਤੁਸੀਂ ਰਹਿਣ ਦਿਓ ਡਰਾਈ ਫਰੂਟ ਵਾਲਾ ਕਰ ਦਿਓ ਠੀਕ ਹੈ ਹਾਂਜੀ ਖਜੂਰ ਇਹ ਨਾ ਮੇਰੇ ਬ੍ਰਦਰ ਦੀ ਫਸਟ ਲੋੜੀ ਹੈ ਅਤੇ ਉਹਦੀ ਲੋਹੜੀ ਸੈਲੀਬਰੇਸ਼ਨ ਲਈ ਆਪਾਂ ਨੂੰ ਇਸ ਚੀਜ਼ ਚਾਹੀਦੀਆਂ ਨੇ

ਅਤੇ ਮੈਨੂੰ ਪਰਸੋਂ ਕੁ ਤੱਕ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਨਾ ਤੁਸੀਂ ਮੈਨੂੰ ਆਪਣੇ ਪੇਮੈਂਟ ਦਾ ਮੋਡ ਦੱਸ ਦਿਓ ਅਤੇ ਮੈਨੂੰ ਸੈਂਡ ਕਰ ਦਿਓ ਮੈਂ ਐਡਵਾਂਸ ਪੇਮੈਂਟ ਜੀ ਤੁਹਾਨੂੰ ਕਰਦੂੰ ਬਟ ਮੇਕ ਸ਼ਯੁਰ ਕਰਿਓ ਕਿ ਸਾਰੀ ਚੀਜ਼ ਆਪਣੀ ਫਰੈਸ਼ ਹੋਣੀ ਚਾਹੀਦੀ ਹੈ ਅਤੇ ਕੁਆਲਿਟੀ ਵੀ ਬੈਸਟ ਹੋਏ ਜੇਹੜੇ ਬੋਕਸ ਨੇ ਤੁਸੀਂ ਜਿਹੜੇ ਤੁਹਾਡੇ ਕੋਲ ਜ਼ਿਆਦਾਤਰ ਵਰਾਇਟੀਸ ਹੈਗੀਆਂ ਪੈਕਿੰਗ ਦੀਆਂ ਤਾਂ ਤੁਸੀਂ ਮੈਨੂੰ ਸ਼ੇਅਰ ਕਰਦੋ ਉਹਨਾਂ ਵਿੱਚੋਂ ਜਿਹੜੀ ਮੈਨੂੰ ਸਹੀ ਲੱਗੂ ਉਹ ਮੈਂ ਤੁਹਾਨੂੰ ਸਲੈਕਟ ਕਰਕੇ ਦੱਸਦੂੰ ਹਾਂਜੀ ਡਿਲੀਵਰੀ ਜੇਕਰ ਤਾਂ ਤੁਹਾਡੇ ਮਤਲਬ ਡਿਲੀਵਰੀ ਜਿਹੜੇ ਹੈਗੇ ਆ ਕਰਨ ਵਾਲੇ ਡਿਲੀਵਰੀ ਬੋਏ ਜੇ ਤਾਂ ਉਹ ਵਧੀਆ ਤਰੀਕੇ ਨਾਲ ਡਿਲੀਵਰੀ ਕਰਨਗੇ ਫਿਰ ਤਾਂ ਤੁਸੀਂ ਖੁਦ ਡਿਲੀਵਰ ਕਰ ਦਿਓ ਅਦਰਵਾਈਜ਼ ਤੁਸੀਂ ਮੈਨੂੰ ਦਸ ਦਿਓ ਕਿਉਂਕਿ ਮੈਂ ਖੁਦ ਵੀ ਲੈ ਕੇ ਜਾ ਸਕਦੀ ਹਾਂ ਕਿਉਂਕਿ ਇੱਦਾਂ ਦੇ ਕੰਪਲੇਂਟਸ ਮੈਂ ਬਹੁਤ ਦੇਖੀਆ ਆ ਕਿ ਜਿਹੜੇ ਡਿਲੀਵਰੀ ਮੈਨ ਹੁੰਦੇ ਆ ਉਹ ਸੀਰੀਅਸ ਨਹੀਂ ਲੈਂਦੇ ਕਿਸੇ ਚੀਜ਼ ਨੂੰ ਉਹ ਰਸਤੇ 'ਚ ਜਾਂਦੀ ਚੀਜ਼ਾਂ ਖ਼ਰਾਬ ਕਰ ਦਿੰਦੇ ਆ ਕਿੰਨੇ ਕੁ ਚਾਰਜਸ ਹੋਣਗੇ ਆਪਣੇ ਇਹ ਲੋਕੇਸ਼ਨ ਆਈ ਥਿੰਕ ਤੁਹਾਡੀ ਸ਼ੋਪ ਤੋਂ ਟਵੈਂਟੀ ਟਵੈਂਟੀ ਫਾਈਵ ਕਿਲੋਮੀਟਰ ਹੋ ਸਕਦੀ ਹੈ ਤੁਹਾਡੇ ਜਿਹੜੇ ਡਿਲੀਵਰੀ ਚਾਰਜਸ ਨੇ ਕੁਛ ਜਿਆਦਾ ਨਹੀਂ ਹੈਗੇ ਮਤਲਬ ਇੰਨੀ ਜ਼ਿਆਦਾ ਵੀ ਨਹੀਂ ਦੂਰ ਹੈਗਾ ਕਿ ਤੁਸੀਂ ਵੰਨ ਇਦਾਂ ਕਹਿ ਰਹੇ ਹੋ ਤੁਸੀਂ ਅਗਰ ਮੈਨੂੰ ਪਰਸੋਂ ਸ਼ਾਮ ਤੱਕ ਪਹੁੰਚ ਜਾਣਾ ਚਾਹੀਦਾ ਸ਼ਾਮ ਤੋਂ ਲੇਟ ਨਹੀਂ ਹੋਣਾ ਚਾਹੀਦਾ ਅਤੇ ਓਕੇ ਅਤੇ ਤੁਸੀਂ ਮੈਨੂੰ ਹਾਂ ਅਤੇ ਤੁਸੀਂ ਮੈਨੂੰ ਪੇਮੈਂਟ ਦਾ ਦੱਸ ਦਿਓ ਅਤੇ ਮੈਂ ਫਿਰ ਤੁਹਾਨੂੰ ਪੇਮੈਂਟ ਕਰਦਾਂ ਓਕੇ ਥੈਂਕ ਯੂ